ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਖਾਣਾ ਪਕਾਉਣ ਦੇ ਸ਼ੌਂਕ ਨੂੰ ਮੇਰੀ ਮੰਮੀ ਨੇ ਵਧਾਇਆ ਹੈ ਇਹ ਮੇਰਾ ਪਹਿਲਾਂ ਸ਼ੌਂਕ ਨਹੀਂ ਸੀ ਕਿਉਂਕਿ ਮੈਨੂੰ ਖਾਣਾ ਬਣਾਉਣਾ ਨਹੀਂ ਸੀ ਪਸੰਦ ਪਰ ਹੁਣ ਇਹ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਮੈਂ ਅਤੇ ਮੇਰੀ ਮਾਂ ਦੋਨੋਂ ਇਕੱਠੇ ਕਿਚਨ ਵਿੱਚ ਖਾਣਾ ਬਣਾ ਲੈਂਦੇ ਹਾਂ ਅਤੇ ਉਹ ਮੈਨੂੰ ਨਵੀਆਂ ਨਵੀਆਂ ਰੈਸਪੀਆਂ ਸਿਖਾਉਂਦੇ ਹਨ ਜਿੱਦਾਂ ਕਿ ਅਸੀਂ ਲੋਕਡਾਊਨ ਵਿੱਚ ਬਹੁਤ ਸਾਰੀਆਂ ਰੈਸਪੀਆਂ ਇਕੱਠੇ ਬਣਾਈਆਂ ਸੀ ਜੋ ਕਿ ਬਹੁਤ ਸਵਾਦ ਵੀ ਬਣੀਆਂ ਸਨ ਅਤੇ ਇਸ ਕਰਕੇ ਅਸੀਂ ਹੁਣ ਰੈਸਪੀਆਂ ਇਕੱਠੇ ਹੀ ਬਣਾਉਂਦੇ ਹਾਂ ਅਸੀਂ ਕੋਈ ਰੈਸਪੀ ਯੂਟਿਊਬ ਤੋਂ ਦੇਖਦੇ ਹਾਂ ਅਤੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਈ ਵਾਰ ਤਾਂ ਉਹ ਰੈਸਪੀ ਨਹੀਂ ਸਹੀ ਬਣਦੀ ਪਰ ਕਈ ਵਾਰ ਬਹੁਤ ਵਧੀਆ ਬਣਦੀ ਹੈ ਕਿ ਬਾਜ਼ਾਰੋਂ ਵੀ ਲੈ ਕੇ ਆਉਣ ਦਾ ਮਨ ਨਹੀਂ ਕਰਦਾ ਸਾਡੇ ਦੋਵਾਂ ਦੀ ਫੇਵਰੇਟ ਰੈਸਪੀ ਹੈ ਪਾਓ ਭਾਜੀ ਬਣਾਉਣਾ ਅਤੇ ਉਹ ਬਾਜ਼ਾਰ ਨਾਲੋਂ ਵੀ ਬਹੁਤ ਸਵਾਦ ਬਣਦੀ ਹੈ ਕਿ ਅਸੀਂ ਹਰ ਵਾਰ ਘਰ ਹੀ ਬਣਾਉਣ 'ਚ ਉਹਨੂੰ ਬਣਾ ਕੇ ਖਾਂਦੇ ਹਾਂ ਅਤੇ ਉਹ ਸਾਰਾ ਪਰਿਵਾਰ ਅਸੀਂ ਬਹੁਤ ਸਵਾਦਾਂ ਨਾਲ ਖਾਂਦੇ ਹਾਂ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਹਿਸਾਬ ਨਾਲ ਕਸਟਮਾਈਜੇਸ਼ਨ ਕਰਕੇ ਕੁਛ ਵੀ ਪਾ ਸਕਦੇ ਹਾਂ ਅਤੇ ਉਹਦਾ ਸਵਾਦ ਵਧਾ ਸਕਦੇ ਹਾਂ ਕਈ ਵਾਰ ਅਸੀਂ ਰੈਸਪੀਆਂ ਬਣਾ ਕੇ ਦੂਜੇ ਕਿਸੇ ਲੋਕ ਨੂੰ ਵੀ ਖਵਾ ਦਿੰਦੇ ਹਾਂ ਕਿਉਂਕਿ ਉਹਨਾਂ ਨੂੰ ਵੀ ਸਾਡੇ ਹੱਥ ਦੀ ਰੈਸਪੀ ਵਧੀਆ ਲੱਗਦੀ ਹੈ ਮੈਂ ਅਤੇ ਮੇਰੀ ਮਾਂ ਦੋਨੋਂ ਕਿਚਨ ਵਿੱਚ ਸਬਜ਼ੀਆਂ ਸੁਬਜ਼ੀਆ ਬਣਾ ਲੈਂਦੇ ਹਾਂ ਜੋ ਕਿ ਸਾਰਿਆਂ ਨੂੰ ਬਹੁਤ ਸਵਾਦ ਲੱਗਦੀਆਂ ਹਨ ਮੈਨੂੰ ਇੰਨੀ ਵਧੀਆ ਤਾਂ ਨਹੀਂ ਬਣਾਉਣੀ ਆਉਂਦੀ ਪਰ ਮੰਮੀ ਮੇਰੀ ਦੀ ਮਦਦ ਨਾਲ ਅਸੀਂ ਸਾਰਾ ਕੁਛ ਵਧੀਆ ਬਣਾ ਲੈਂਦੇ ਹਾਂ ਅਤੇ ਸਾਰੇ ਕਹਿੰਦੇ ਹਨ ਕਿ ਬਹੁਤ ਵਧੀਆ ਬਣਾਉਣਾ ਆਉਂਦਾ ਹੈ ਸਮਾਨ ਤੁਹਾਡੀ ਕੁੜੀ ਨੂੰ ਵੀ